ਸਾਡੇ ਪਿੰਡ ਵਿੱਚ ਨਾ ਹੀ ਐਂਬੂਲੈਂਸ ਹੈ ਨਾ ਹੀ ਐਬੂਲੈਂਸ ਦੀ ਕੋਈ ਕੋਨੈਕਟਿਵਿਟੀ ਹੈ ਮਰੀਜ਼ ਬਿਮਾਰ ਹੋਣ ਤੋਂ ਐਂਬੂਲੈਂਸ ਤੋਂ ਬਗੈਰ ਹਸਪਤਾਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਐਂਬੂਲੈਂਸ ਹੋਣਾ ਜ਼ਰੂਰੀ ਹੈ ਸੜਕ ਵੀ ਖਰਾਬ ਹੈ ਐਂਬੂਸ ਐਬੂਲੈਂਸ ਆਉਣ ਲੱਗਿਆਂ ਬਹੁਤ ਟਾਈਮ ਲੱਗਦਾ ਹੈ ਪਿੰਡ ਵਿੱਚ ਇੱਕ ਐਬੂਲੈਂਸ ਹੋਣੀ ਚਾਹੀਦੀ ਹੈ